ਹੈਲੋ ਹਾਂਜੀ ਹਾਂਜੀ ਬਣਵਾ ਲਓ ਬਣਾ ਦੇਵਾਂਗੇ ਹਾਂਜੀ ਹਾਂਜੀ ਹਾਂਜੀ ਜੀ ਅੱਛਾ ਸੋਫੇ ਵੀ ਵਿੱਚੇ ਕ ਕਰਵਾਉਣੇ ਤਿਆਰ ਹੈ ਬਹੁਤ ਵਧੀਆ ਮੇਜ਼ ਵੀ ਨਾਲ ਤਿਆਰ ਕਰਦੇ ਹੈ ਅਤੇ ਵੀ ਵਧੀਆ ਹੀ ਸੋਫਾ ਬਣੇਗਾ ਅਤੇ ਬੈੱਡ ਵੀ ਵਧੀਆ ਬਹੁਤ ਵਧੀਆ ਜੀ ਬਣਨਗੇ ਹੈ ਬੈੱਡ ਤਾਂ ਹਾਂਜੀ ਉਹਦੇ ਉੱਤੇ ਨਾਲ ਦਾ ਹੀ ਕੱਪੜਾ ਨਾਲ ਦਾ ਕੱਪੜਾ ਲਗਾਵਾਂਗੇ ਅਤੇ ਉਹਦਾ ਲੱਕੜ ਦਾ ਹੀ ਬਣੇਗਾ ਪਲਾਈ ਦੇ ਉੱਤੇ ਫਿਰ ਅਸੀਂ ਕੱਪੜਾ ਉੱਤੇ ਨਾਲ ਚੜ੍ਹੇਗਾ ਵਧੀਆ ਹਾਂ ਵਧੀਆ ਬਹੁਤ ਵਧੀਆ ਬਣਦਾ ਸਾਡੀ ਦੁਕਾਨ ਤੋਂ ਤਾਂ ਬਹੁਤ ਦੂਰ ਦੂਰ ਤਾਈਂ ਲੋਕ ਲੈ ਕੇ ਜਾਂਦੇ ਹੈ ਆਏਂ ਨਹੀਂ ਮਾੜੀ ਨਹੀਂ ਬਣੇਗੀ ਚੀਜ਼ ਹਾਂ ਹਾਂ ਲੱਕੜ ਦੀਆਂ ਕੁਰਸੀਆਂ ਬਹੁਤ ਸੋਹਣੀਆਂ ਬਣਦੀਆਂ ਹੈ ਹਾਂਜੀ ਜੀ ਉਹ ਵੀ ਕਰ ਦਿੰਦੇ ਹਾਂ ਹਾਂ ਸਾਰਾ ਕੁਛ ਹੀ ਅਸੀਂ ਤਾਂ ਬਣਾਉਣਦੇ ਹੈ ਸਾਡੀ ਦੁਕਾਨ 'ਤੇ ਤਾਂ ਬਹੁਤ ਕੁਛ ਹੀ ਬਣਦਾ ਹੈ ਅਸੀਂ ਬਹੁਤ ਹੀ ਬਣਾਈ ਜਾਂਦੀਆਂ ਹੈ ਜਿਹੜੀ ਤੁਸੀਂ ਕਹੋਗੇ ਨਿੰਮ ਦੀ ਲਵਾਉਣੀ ਹੈ ਟਾਹਲੀ ਦੀ ਲਵਾਉਣੀ ਹੈ ਸ਼ਪੈਦਾ ਲਵਾਉਣਾ ਹੈ ਸਾਗਵਾਨ ਲਵਾਉਣਾ ਹੈ ਜਿਹੜੀ ਵੀ ਕਹੋਗੇ ਨਿੰਮ ਦੀ ਲਗਾਉਣੀ ਹੈ ਜਿਹੜੀ ਵੀ ਕਹੋਗੇ ਉਹ ਹੀ ਲਗਾ ਦੇਵਾਂਗੇ ਲੱਕੜ ਸਾਡੇ ਬਹੁਤ ਵਧੀਆ ਹੁੰਦੀ ਹੈ ਨਹੀਂ ਜਾਂ ਤਾਂ ਨਿੰਮ ਨੂੰ ਨਹੀਂ ਸਿਓਂਕ ਪੈਂਦੀ ਅਤੇ ਜਾਂ ਪੈਂਦੀ ਨਹੀਂ ਸਾਗਵਾਨ ਨੂੰ ਸਿਓਂਕ ਇਹ ਚੀਜਾਂ ਨਹੀਂ ਸਿਓਂਕ ਨਹੀਂ ਪੈਂਦੀ ਗੀ ਅਤੇ ਪੈਂਦੀ ਸ਼ਪੈਦੇ ਨੂੰ ਵੀ ਨਹੀਂ ਹਾ ਸਿਓਂਕ ਤਾਂ ਹਾਂ ਹਾਂ ਹਾਂ ਕਰਵਾਓ ਅਸੀਂ ਬਣਾ ਦੇਵਾਂਗੇ ਸਾਰਾ ਕੁਛ ਰਸੋਈ ਦਾ ਵੀ ਵਿੱਚ ਤਿਆਰ ਕਰਾਂਗੇ ਹਾਂਜੀ ਅੱਛਾ ਹਾਂ ਹਾਂ ਕੋਈ ਨਹੀਂ ਵਧੀਆ ਬਣਾਵਾਂਗੇ ਫਿਲਟਰ ਵਾਲਾ ਅਸੀਂ ਅੱਡ ਬਣਾਵਾਂਗੇ ਰਕਨਾ ਅਤੇ ਸਿਲੈਂਡਰ ਵਾਲਾ ਅੱਡ ਬਣੇਗਾ ਵੀ ਜੋ ਜਿਵੇਂ ਆਪਾਂ ਭਾਂਡਾ ਟੀਂਡਾ ਜੋ ਵੀ ਰੱਖਣਾ ਹੈ ਸਾਰੇ ਅੱਡੋ ਅੱਡੀ ਰਕਨੇ ਬਣਨਗੇ ਅਤੇ ਬਹੁਤ ਸੋਹਣੀ ਤਿਆਰ ਹੋਵੇਗੀ ਰਸੋਈ ਸੋਫਾ ਸਾਡੇ ਬਹੁਤ ਵਧੀਆ ਇੱਥੋਂ ਬੈੱਡ ਵੀ ਮਿਲਦੇ ਆ ਸੋਫੇ ਵੀ ਜਿਹੜਾ ਮਰਜ਼ੀ ਲੈ ਕੇ ਜਾਓ ਅਤੇ ਜੇ ਕਹੋਗੇ ਤਾਂ ਅਸੀਂ ਬਣਾ ਦੇਵਾਂਗੇ ਅਤੇ ਜੇ ਬਣਿਆ ਬਣਾਇਆ ਚੁੱਕਣਾ ਤਾਂ ਉਹ ਲੈ ਜਾਓ ਜਿਹੜਾ ਹੀ ਤੁਹਾਨੂੰ ਪਸੰਦ ਅਸੀਂ ਓਹੋ ਜਿਹਾ ਹੀ ਬਣਾ ਦੇਵਾਂਗੇ ਠੀਕ ਆ